ਹੈਲੋ ਵਧੀਆ ਤੂੰ ਸੁਣਾ ਚੱਲ ਵਧੀਆ ਸਹੀ ਆ ਹੋਰ ਘਰ ਪਰਿਵਾਰ ਸਭ ਵਧੀਆ ਹਾਂ ਸਭ ਵਧੀਆ ਹੋਰ ਕੀ ਕਰਦੀ ਫਿਰ ਅੱਜ ਕੱਲ੍ਹ ਅੱਛਾ ਯਾਰ ਮੈਂ ਨਾ ਸੋਚਣ ਰਹੀ ਹਾਂ ਕਿ ਸਟਾਰਟ ਅਪ ਦਾ ਨਾ ਸੋਚੀਏ ਅੱਗੇ ਦਾ ਅੱਛਾ ਕੋਈ ਆਈਡੀਆ ਹੈਗਾ ਤਾਂ ਦੱਸ ਹੂੰ ਸਟੇਸ਼ਨਰੀ ਦਾ ਹਾਂ ਸਟੇਸ਼ਨਰੀ ਇਕੱਲੀ ਪਰ ਚੱਲ ਜੂਗੀ ਮਤਲਬ ਹੂੰ ਹਾਂ ਅਤੇ ਇੱਦਾਂ ਵੀ ਕਰਾਂਗੇ ਵੀ ਜੇ ਤਾਂ ਮਤਲਬ ਵਧੀਆ ਰਿਸਪਾਂਸ ਹੋਇਆ ਤਾਂ ਫਿਰ ਜਿਸ ਤਰਾਂ ਬੁਕਸ ਵਗੈਰਾ ਆਪਾਂ ਨੂੰ ਲੈਣ ਲਈ ਸ਼ਹਿਰ ਜਾਣਾ ਪੈਂਦਾ ਸੀਗਾ ਅਤੇ ਉਹ ਵੀ ਚੱਲ ਆਪਾਂ ਹੋਲਸੇਲ 'ਤੇ ਲੈ ਆਂਦੀਆਂ ਅਤੇ ਜਿਹੜਾ ਬੱਚਿਆਂ ਨੂੰ ਵੀ ਆਪਣੇ ਪਿੰਡ ਤੋਂ ਕਹਿ ਲਾ ਬਾਹਰ ਨਾ ਜਾਣਾ ਪਿਆ ਅਤੇ ਦੁਕਾਨ ਕਿੱਥੇ ਆ ਤੁਹਾਡੀ ਹਾਂ ਅੱਛਾ ਚਲੋ ਵਧੀਆ ਫਿਰ ਤਾਂ ਨਾ ਅਤੇ ਆਉਣ ਜਾਣ 'ਤੇ ਵੀ ਦਿੱਕਤ ਨਹੀਂ ਹੋਊਗੀ ਨਾ ਚੱਲ ਫਿਰ ਇਸ ਤਰ੍ਹਾਂ ਕਰਦੇ ਹਾਂ ਵੀ ਮੈਂ ਵੀ ਆਪਣੇ ਘਰ ਪੁੱਛ ਲੈਂਦੀ ਹਾਂ ਅਤੇ ਤੂੰ ਵੀ ਗੱਲ ਕਰਲਾ ਅਤੇ ਆਪਾਂ ਆਹ ਸੋਚਿਆ ਫਿਰ ਅਤੇ ਜੇ ਮਨ ਜਾਂਦੇ ਆ ਤਾਂ ਫਿਰ ਆਪਾਂ ਹਾਂ ਫਿਰ ਆਪਾਂ ਕਰ ਲੈਂਦੇ ਹਾਂ ਕੱਲ੍ਹ ਮਿਲ ਲੈਂਦੇ ਹਾਂ ਹਾਂ ਚਲ ਠੀਕ ਆ ਫਿਰ ਸਤਿ ਸ਼੍ਰੀ ਅਕਾਲ